ਮੇਰੀ ਜੋ ਮਨਪਸੰਦ ਜੋ ਮੇਰੇ ਦੁਆਰਾ ਲਿਖੀ ਗਈ ਜੋ ਵੀ ਚੀਜ਼ ਸੀ ਉਹ ਇੱਕ ਕਵਿਤਾ ਸੀ ਜਿਸ ਦੇ ਵਿੱਚ ਕਿ ਮੈਂ ਪੰਜਾਬ ਨਾਲ ਸਬੰਧਿਤ ਮਤਲਬ ਪੰਜਾਬ ਉੱਪਰ ਲਿਖੀ ਅਤੇ ਪੰਜਾਬ ਨਾਲ ਸੰਬੰਧਿਤ ਬਹੁਤ ਸਾਰੀਆਂ ਮਤਲਬ ਗੱਲਾਂ ਨੂੰ ਮੈਂ ਵਿੱਚ ਐਡ ਕੀਤਾ ਕਿ ਜਿਵੇਂ ਕਿ ਮੈਨੂੰ ਮੇਰੇ ਸਾਡੇ ਪਹਿਰਾਵੇ ਸਾਡੇ ਕਲਚਰ ਸਾਡੀ ਬੋਲੀ ਸਾਡੀ ਧਾਰਮਿਕ ਚੀਜ਼ਾਂ ਧਾਰਮਿਕ ਗੱਲਾਂ ਇਤਿਹਾਸਿਕ ਜੋ ਵੀ ਜੋ ਵੀ ਸਾਡੇ ਆਸ ਪਾਸ ਜੋ ਵੀ ਥਾਵਾਂ ਹਨ ਉਹਨਾਂ ਚੀਜ਼ਾਂ ਨੇ ਮੈਨੂੰ ਇਸ ਕਵਿਤਾ ਨੂੰ ਲਿਖਣ ਲਈ ਪ੍ਰੇਰਿਤ ਕੀਤਾ ਅਤੇ ਮੈਂ ਇਹਨਾਂ ਸਭ ਚੀਜ਼ਾਂ ਨੂੰ ਇੱਕ ਕਵਿਤਾ ਦੇ ਵਿੱਚ ਮਤਲਬ ਆਪਣੇ ਸਮਝ ਦੇ ਅਕੋਡਿੰਗ ਮੈਂ ਇਹਨਾਂ ਸਭ ਚੀਜ਼ਾਂ ਨੂੰ ਬਿਆਨ ਕੀਤਾ ਕਿ ਸਾਡੇ ਜੋ ਪੰਜਾਬ ਵਿੱਚ ਕਿਸ ਤਰ੍ਹਾਂ ਦੇ ਰਹਿਣ ਸਹਿਣ ਹੈ ਕਿਸ ਤਰ੍ਹਾਂ ਦਾ ਖਾਣ ਪੀਣ ਹੈ ਕਿਸ ਤਰ੍ਹਾਂ ਦਾ ਜੋ ਸਾਡਾ ਧਾਰਮਿਕ ਜੋ ਵੀ ਸਾਡੀਆਂ ਸਾਡੇ ਗੁਰੂਆਂ ਪੀਰਾਂ ਨੇ ਜੋ ਹੁਣ ਤੱਕ ਸਾਡਾ ਇਤਿਹਾਸ ਹੈ ਉਸ ਬਾਰੇ ਮੈਂ ਵਰਣਨ ਕੀਤਾ ਅਤੇ ਇਹਨਾਂ ਸਭ ਚੀਜ਼ਾਂ ਦੇ ਨਾਲ ਹੀ ਪ੍ਰੇਰਿਤ ਹੋ ਕੇ ਇਹਨਾਂ ਸਭ ਚੀਜ਼ਾਂ ਨੇ ਹੀ ਮੈਨੂੰ ਪ੍ਰੇਰਿਤ ਕੀਤਾ ਅਤੇ ਉਸ ਲਈ ਉਸ ਨੂੰ ਮੈਂ ਇੱਕ ਕਵਿਤਾ ਰਾਹੀਂ ਆਪਣੇ ਸ਼ਬਦਾਂ ਵਿੱਚ ਆਪਣੇ ਸ਼ਬਦਾਂ ਨੂੰ ਉਸ ਕਵਿਤਾ ਰਾਹੀਂ ਬਿਆਨ ਕੀਤਾ ਅਤੇ ਮੈਂ ਇਸ ਨੂੰ ਪੰਜਾਬੀ ਵਿੱਚ ਲਿਖਣਾ ਮੈਨੂੰ ਲਿਖ ਕੇ ਪਰਾਊਡ ਫੀਲ ਹੋਇਆ ਅਤੇ ਦੂਜਾ ਮੈਨੂੰ ਪੰਜਾਬੀ ਵਿੱਚ ਲਿਖਣਾ ਹੀ ਸਭ ਤੋਂ ਜ਼ਿਆਦਾ ਬੈਸਟ ਲੱਗਾ ਸਭ ਤੋਂ ਜ਼ਿਆਦਾ ਪਸੰਦੀਦਾ ਲੱਗਾ